ਮੇਰਾ ਪਸੰਦੀਦਾ ਅਭਿਨੇਤਾ ਧਰਮਿੰਦਰ ਹੈ ਜੋ ਕਿ ਉੱਨੀ ਸੌ ਸੱਠ ਵਿੱਚ ਪਹਿਲੀ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਰਾਹੀਂ ਅਭਿਨੇਤਾ ਦੇ ਤੌਰ 'ਤੇ ਫਿਲਮ ਜਗਤ ਵਿੱਚ ਸਾਹਮਣੇ ਆਏ ਉਨ੍ਹਾਂ ਨੇ ਸ਼ੋਹਲੇ ਡਰੀਮ ਗਰਲ ਆਜ਼ਾਦ ਧਰਮਵੀਰ ਮੇਰਾ ਗਾਓ ਮੇਰਾ ਦੇਸ਼ ਸਮੱਗਲਰ ਦਾ ਬਾਰਨਿੰਗ ਟਰੇਨ ਫੂਲ ਔਰ ਪੱਥਰ ਪਾਕਿਟਮਾਰ ਇਨਸਾਫ਼ ਕੀ ਪੁਕਾਰ ਆਸ ਪਾਸ ਸਰਾਫਤ ਸੂਰਤ ਔਰ ਸੀਰਤ ਰਾਜਾ ਜਾਨੀ ਸੀਤਾ ਔਰ ਗੀਤਾ ਨਵਾਂ ਜ਼ਮਾਨਾ ਜਸ ਅਤੇ ਦੋਸਤ ਫ਼ਿਲਮਾਂ ਵਿੱਚ ਅਭਿਨੇਤਾ ਦੇ ਤੌਰ 'ਤੇ ਭੂਮਿਕਾ ਨਿਭਾਈ ਫਿਲਮ ਸ਼ੋਹਲੇ ਵਿੱਚ ਉਹਨਾਂ ਦੁਆਰਾ ਨਿਭਾਏ ਗਏ ਕਿਰਦਾਰ ਵਿੱਚ ਵਿਅਕਤੀਤਵ ਦੇ ਗੁਣ ਦੀ ਵੀ ਵਧੀਆ ਮਿਸਾਲ ਮਿਲਦੀ ਹੈ ਦੋਸਤੀ ਦੇ ਨਾਲ ਨਾਲ ਵਫਾਦਾਰੀ ਨਿਭਾਉਂਦੇ ਹੋਏ ਉੱਚ ਕਿਰਦਾਰ ਵਜੋਂ ਜਾਣੇ ਜਾਂਦੇ ਹਨ ਇਹੋ ਕਾਰਨ ਹੈ ਕਿ ਉੱਨੀ ਸੌ ਸੱਠ ਸੱਤਰ ਦਹਾਕੇ ਵਿੱਚ ਉਹਨਾਂ ਦੀਆਂ ਸਾਰੀਆਂ ਫਿਲਮਾਂ ਸੁਪਰਹਿੱਟ ਰਹੀਆਂ ਹਨ